ਪੰਜਾਬ ਵਿੱਚ ਸਿਹਤ ਸੰਭਾਲ਼ ਟੈਕਨੋਲਜੀ ਦੀ ਵਰਤੋਂ ਬਹੁਤ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਸਰਕਾਰ ਨੇ ਇਹਨਾਂ ਟੈਕਨੋਲਜੀਕਲ ਵਸਤੂਆਂ ਦੀ ਸਾਂਭ ਸੰਭਾਲ਼ ਦੇ ਲਈ ਕਰਮਚਾਰੀ ਨਿਯੁਕਤ ਕੀਤੇ ਹੋਏ ਹਨ